ਮੈਂ ਅੰਮ੍ਰਿਤ ਕੌਰ ਸ਼ਹੀਦ ਭਗਤ ਸਿੰਘ ਨਗਰ ਦੀ ਵਾਸੀ ਹਾਂ ਜੀ ਸ਼ਹੀਦ ਭਗਤ ਸਿੰਘ ਨਗਰ ਵਿੱਚ ਜਾਣਕਾਰੀ ਦੇ ਬਹੁਤ ਸਾਰੇ ਸਰੋਤ ਹਨ ਜਿਨ੍ਹਾਂ ਵਿੱਚੋਂ ਮੈਨੂੰ ਅਖਬਾਰ ਪੜ੍ਹਨਾ ਬਹੁਤ ਵਧੀਆ ਲੱਗਦਾ ਹੈ ਅਖਬਾਰ ਤਾਂ ਬਹੁਤ ਸਾਰੇ ਆਉਂਦੇ ਨੇ ਜਗਬਾਣੀ ਪੰਜਾਬ ਕੇਸਰੀ ਹੋਰ ਵੀ ਇੰਗਲਿਸ਼ ਦੇ ਬਹੁਤ ਸਾਰੇ ਅਖਬਾਰ ਆਉਂਦੇ ਨੇ ਜਿਨ੍ਹਾਂ ਵਿੱਚੋਂ ਕਿ ਮੈਨੂੰ ਅਜੀਤ ਅਖਬਾਰ ਪੜ੍ਹਨੀ ਬਹੁਤ ਵਧੀਆ ਲੱਗਦੀ ਹੈ ਇਹਦੇ ਵਿੱਚ ਬਹੁਤ ਵਧੀਆ ਖਬਰਾਂ ਛਾਪੀਆਂ ਹੁੰਦੀਆਂ ਹਨ ਇਸ ਵਿੱਚ ਜਿੰਨੀਆਂ ਵੀ ਸਾਡੇ ਏਰੀਏ ਦੀਆਂ ਖਬਰਾਂ ਹੁੰਦੀਆਂ ਹਨ ਜੋ ਵੀ ਵਧੀਆ ਕੰਮ ਜਾਂ ਕੁਛ ਵੀ ਬਹੁਤ ਚੰਗੇ ਢੰਗ ਨਾਲ ਖਬਰਾਂ ਦਿੱਤੀਆਂ ਗਈਆਂ ਹੁੰਦੀਆਂ ਹਨ ਇਹਦੇ ਵਿੱਚ ਕੋਈ ਭੜਕਾਊ ਨਿਊਜ਼ ਨਹੀਂ ਹੁੰਦੇ ਜਾਂ ਕੋਈ ਰਾਜਨੀਤਿਕ ਖਬਰਾਂ ਨਹੀਂ ਹੁੰਦੀਆਂ ਬਹੁਤ ਵਧੀਆ ਗੱਲਾਂ ਦੱਸੀਆਂ ਜਾਂਦੀਆਂ ਹਨ ਬੱਚਿਆਂ ਦੇ ਪੜ੍ਹਨ ਦੀਆਂ ਵੀ ਬਹੁਤ ਸੋਹਣੀਆਂ ਕਹਾਣੀਆਂ ਬਾਲ ਸੰਸਾਰੀਏ ਸਭ ਕੁਛ ਬਹੁਤ ਵਧੀਆ ਹੁੰਦਾ ਜਿਹਦੇ ਨਾਲ ਕਿ ਬੱਚਿਆਂ ਨੂੰ ਵੀ ਬਹੁਤ ਵਧੀਆ ਗਾਈਡੈਂਸ ਮਿਲਦੀ ਆ ਮੈਨੂੰ ਅਖਬਾਰ ਪੜ੍ਹਨੀ ਬਹੁਤ ਵਧੀਆ ਲੱਗਦੀ ਹੈ ਔਰ ਮੈਂ ਆਪਣੇ ਬੱਚਿਆਂ ਨੂੰ ਵੀ ਗਾਈਡ ਕਰਦੀ ਹਾਂ ਕਿ ਇਸ ਅਖਬਾਰ ਨੂੰ ਪੜ੍ਹਿਆ ਕਰੋ ਬਹੁਤ ਬਹੁਤ ਧੰਨਵਾਦ ਜੀ